ਅਕਸਰ ਦੇਖੇ ਜਾਣ ਵਾਲੇ ਪੰਛੀ ਚਿੜੀਆਂ ਕੋਇਲ ਕਬੂਤਰ ਗਟਾਰਾਂ ਘੁੱਗੀਆਂ ਤੋਤੇ ਮੋਰ ਕਾਂ ਚੱਕੀਹਾਰਾ ਆਦਿ ਪਸੰਦ ਪਸੰਦ ਪੰਛੀ ਮੇਰਾ ਪਸੰਦ ਪੰਛੀ ਮੋਰ ਹੈ ਕਿਉਂਕਿ ਉਹ ਬਹੁਤ ਸੋਹਣਾ ਸੁੰਦਰ ਹੁੰਦਾ ਹੈ ਉਸਦੀ ਦਿੱਖ ਸਾਰੇ ਪੰਛੀਆਂ ਨਾਲੋਂ ਅਲੱਗ ਹੈ ਉਹ ਮਨਮੋਹਣਾ ਪੰਛੀ ਹੈ ਉਹ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜਦੋਂ ਮੀਂਹ ਪੈਂਦਾ ਹੈ ਤਾਂ ਮੋਰ ਪੈਲ ਪਾਉਂਦਾ ਹੈ ਆਪਣੇ ਖੰਭ ਖਿਲਾਰ ਕੇ ਜਿਸ ਨਾਲ ਉਸ ਖੰਭ ਖੰਭ ਉਹ ਸੋਹਣੇ ਲੱਗਦੇ ਹਨ ਉਸਦੇ ਖੰਭਾਂ ਵਿੱਚ ਕਾਫੀ ਸਾਰੇ ਰੰਗ ਹੁੰਦੇ ਹਨ ਇੰਝ ਲੱਗਦਾ ਹੈ ਉਸਦੇ ਖੰਭ ਰੈਂਬੋ ਦਾ ਰੂਪ ਲੈਂਦੇ ਹਨ ਉਸਦੀ ਆਵਾਜ਼ ਬਹੁਤ ਸੋਹਣੀ ਅਤੇ ਸੁਰੀਲੀ ਹੁੰਦੀ ਹੈ ਜਦੋਂ ਉਹ ਤੁਰਦਾ ਹੈ ਉਹ ਬਹੁਤ ਸੋਹਣਾ ਲੱਗਦਾ ਹੈ ਮੋਰ ਹੋਰ ਕਈ ਰੰਗਾਂ ਦੇ ਹੁੰਦੇ ਹਨ ਸਾਰੇ ਹੀ ਸੋਹਣੇ ਲੱਗਦੇ ਹਨ ਜ਼ਿਆਦਾਤਰ ਇਹ ਸ ਇਹ ਸਾਵਣ ਮੌਸਮ ਵਿੱਚ ਦੇਖਣ ਨੂੰ ਮਿਲਦੇ ਹਨ ਮੋਰ ਸਾਡਾ ਰਾਸ਼ਟਰੀ ਪੰਛੀ ਹੈ ਕਿਉਂਕਿ ਇਹ ਸਾਰਿਆਂ ਨਾਲੋਂ ਸੁੰਦਰ ਪੰਛੀ ਹੁੰਦਾ ਹੈ